ਹੈਲੋ ਸਤਿ ਸ਼੍ਰੀ ਅਕਾਲ ਨਹੀਂ ਨਹੀਂ ਹੋਰ ਸੁਣਾਓ ਤੁਸੀਂ ਠੀਕ ਹੋ ਹਾਂ ਭੈਣ ਵਧੀਆ ਮੈਂ ਤਾਂ ਥਾਡੇ ਨਾਲ ਇੱਕ ਗੱਲ ਕਰਨੀ ਸੀ ਸਕੂਲ ਬਾਰੇ ਬੱਚਿਆਂ ਬਾਰੇ ਗੱਲ ਕਰਨੀ ਸੀ ਸਾ ਵੀ ਬੱਚੇ ਨਾ ਐਵੇਂ ਚੁੱਪ ਚਾਪ ਜੇ ਰਹਿੰਦਾ ਨੇ ਸਕੂਲ ਕਿਹੋ ਜਿਹਾ ਹੈਗਾ ਵੀ ਪੜ੍ਹਾਈ ਵੀ ਹੁੰਦੀ ਹ ਕਿ ਨਹੀਂ ਸਕੂਲ ਵਿੱਚ ਤੁਹਾਡੇ ਬੱਚੇ ਸਕੂਲ ਵਿੱਚ ਠੀਕ ਨੇ ਅੱਛਾ ਆ ਸਾਡੇ ਸਾਡੇ ਮੁੰਡੇ ਨਾਲ ਵੀ ਐਵੇਂ ਬੱਚੇ ਨਾਲ ਕੀਤਾ ਮੈਡਮ ਨੇ ਨਾ ਟੈਸਟ ਦਿੱਤਾ ਸੀ ਨੰਬਰ ਵੀ ਥੋੜੇ ਜਿਹੇ ਘੱਟ ਸੀ ਇੱਕ ਦੋ ਮੈਡਮ ਨੇ ਸਾਰੇ ਹੀ ਉਹਨਾਂ ਨੂੰ ਟੋਪ ਵਿਚ ਖੜਾ ਕਰਤਾ ਕਿੰਨੀ ਦੇਰ ਇੱਕ ਦੋ ਘੰਟੇ ਤੋਂ ਵਿਚਾਰਾ ਥੱਕ ਗਿਆ ਸੀ ਬੱਚੇ ਤੇ ਵੈਸੇ ਹੀ ਛੋਟੇ ਨਾਜੁਕ ਹੁੰਦੇ ਨੇ ਤਾਂ ਉਹਨਾਂ ਨੂੰ ਤਾਂ ਹੋਰ ਧੁੱਪ ਚ ਖੜਾ ਕਰਨ ਪੜ੍ਹਾਈ ਦੇ ਪਿੱਛੇ ਤੁਹਾਡੇ ਕੋਲ ਐਨਾ ਕੋਲ ਪੜਾਇਆ ਵੀ ਨਹੀਂ ਜਾਂਦਾ ਚੰਗੀ ਤਰ੍ਹਾਂ ਬਹੁਤ ਇਹਨਾਂ ਨੂੰ ਸਟਾਫ ਖਰਾਬ ਹ ਟੀਚਰਾਂ ਦਾ ਕਲਾਸ ਟੀਚਰ ਪਹਿਲਾਂ ਵਰਗੀਆਂ ਨਹੀਂ ਰਹਿ ਗਈ ਪੜ੍ਹਾਈ ਵੀ ਨਹੀਂ ਕਰਾਂਦੀਆਂ ਬੱਚਿਆਂ ਨੂੰ ਹੋਰ ਮਾਰਦੀਆਂ ਕ ਫੀਸ ਇਨੀ ਜਿਆਦਾ ਲੈਂਦੇ ਨੇ ਐਡਮਿਸ਼ਨ ਫੀਸ ਫਿਰ ਵੀ ਜਿਆਦਾ ਹੈਗੇ ਵੇਖਦੇ ਆ ਕੋਈ ਹੋਰ ਸਕੂਲ ਵਧੀਆ ਕੋਈ ਹੋਏ ਆਪਣੇ ਤੇ ਹਾਂ ਜਿਵੇਂ ਸਿਮਰ ਸਨ ਸਾਈਨ ਵੀ ਹੈ ਜੈਨ ਸਕੂਲ ਵੀ ਹੈ ਉਹ ਜੈਨ ਸਕੂਲ ਹੁਣ ਸਹੀ ਨੀ ਉਹਦੇ ਚ ਬੱਚੇ ਪੜਦੇ ਨੇ ਸਹੀ ਨਹੀਂ ਮੈਡਮ ਪੜਾਦੀਆਂ ਨੀ ਟੀਚਰ ਤਾਂ ਬਹੁਤ ਹੀ ਲਾਪ੍ਰਵਾਹ ਹੋਗੀਆ ਨੇ ਸਕੂਲ ਵਧੀਆ ਹੈਗਾ ਗੁਰੂ ਨਾਨਕ ਕਾਲਜ ਵੀ ਸਕੂਲ ਹੈਗਾ ਗੁਰੂ ਨਾਨਕ ਤੇ ਕਹਿੰਦੇ ਓਥੇ

ਹਾਂ ਪੇਰੈਂਟਸ ਮੀਟਿੰਗ ਵੀ ਕਰਦੇ ਨੇ ਜੈਸੇ ਜਿਵੇਂ ਕਿਵੇਂ ਵੀ ਬੱਚੇ ਦਾ ਕੋਈ ਹੈਲਥ ਵਗੈਰਾ ਹੋ ਤੋ ਫੋ ਫੋਨ ਨੰਬਰ ਵੀ ਮੈਂ ਦੇ ਦੋ ਚਾਹੇ ਉਹਨਾਂ ਨੂੰ ਫੋਨ ਤੇ ਵੀ ਗੱਲ ਕਰ ਲੈਂਦੇ ਸਾਨੂੰ ਦੱਸ ਦਿਆ ਕਰਨਗੇ ਨਾ ਆਪਣੇ ਬੱਚਿਆਂ ਬਾਰੇ ਵੀ ਸਾਡੇ ਬੱਚੇ ਕਿਵੇਂ ਪੜ੍ਹਾਈ ਵਿੱਚ ਹੈਗੇ ਨੇ ਜਾਂ ਸਹੀ ਚਲਦੇ ਪਏ ਨੇ ਕਿਵੇਂ ਨੇ ਤੇ ਸਾਨੂੰ ਫੋਨ ਕਾਲ ਕਰਕੇ ਵੀ ਦੱਸਦੇ ਆ ਕਰਨਗੇ ਨਾਲੇ ਟੂਸ਼ਨਾਂ ਦੀ ਵੀ ਕਹਿੰਦੇ ਰਹਿੰਦੇ ਨੇ ਕਿ ਬੱਚੇ ਨੂੰ ਟਿਊਸ਼ਨ ਲਗਾਓ ਹੁਣ ਇੰਨਾਂ ਛੋਟਾ ਬੱਚਾ ਹੈਗਾ ਇੱਕ ਤਾਂ ਤਿੰਨ ਦੋ ਢਾਈ ਵਜੇ ਵੈਸੇ ਹੀ ਵੱਜ ਜਾਂਦੇ ਨੇ ਟਾਈਮ ਹੋ ਜਾਂਦਾ ਟਿਊਸ਼ਨ ਬੱਚੇ ਦਾ ਸਾਥ ਦੇਣ ਲੱਗਿਆ ਨਾਲੇ ਇਹਨਾਂ ਦੀ ਦੀਦੀ ਪੜਾ ਦਿੰਦੀ ਟਿਊਸ਼ਨ ਦੇ ਤਾਂ ਲੋੜ ਹੀ ਨਹੀਂ ਹੈਗੀ ਹਾਂਜੀ ਕੋਈ ਗੱਲ ਨਹੀਂ ਘਰੇ ਪੜਾਈ ਲੈਂਦੇ ਨਾ ਬੱਚੇ ਨੂੰ ਤੇ ਟਿਊਸ਼ਨ ਦੀ ਹਜੇ ਐਨੀ ਛੋਟੇ ਬੱਚਿਆਂ ਨੂੰ ਕਿੱਥੇ ਟੂਸ਼ਨ ਲਾਈ ਹ ਵੱਡੇ ਹੋਣ ਤਾਂ ਲਾ ਵੀ ਲਈਏ ਹੁਣ ਤਾਂ ਅਜੇ ਛੋਟੇ ਬੱਚੇ ਨੇ ਉਹ ਵਿਚਾਰੇ ਉਦਾ ਥੱਕ ਜਾਂਦੇ ਨੇ ਛੋਟੇ ਤਾਂ ਹੈਗੇ ਨੇ ਸਹੀ ਗੱਲ ਹ ਸਕੂਲ ਪਹਿਲਾਂ ਵਰਗਾ ਰਿਹਾ ਨਹੀਂ ਗਿਆ ਕੋਈ ਵਧੀਆ ਸਕੂਲ ਹੀ ਪਾਵਾਂਗੇ ਆਪਾਂ ਆਪਣੇ ਬੱਚੇ ਹਾਂ ਹੈਗੀ ਗੁਰੂ ਨਾਨਕ ਸਕੂਲ ਪਣਾਉਂਦੀ ਹ ਉਹ ਨਹੀਂ ਹੈਗਾ ਸਕੂਲ ਬਹੁਤ ਵਧੀਆ ਹੈਗਾ ਤੁਸੀਂ ਨਾ ਉੱਥੇ ਆਪਣੇ ਬੱਚੇ ਪਾ ਦੋ ਤੇ ਪੜ੍ਹਾਈ ਵਧੀਆ ਜਿਆਦਾ ਇਨੀ ਫੀਸ ਵੀ ਨਹੀਂ ਹੈਗੀ ਉੱਥੇ ਆਪਾਂ ਵੀ ਉੱਥੇ ਆਪਣੇ ਬੱਚੇ ਸਕੂਲ ਵਿੱਚ ਪਾ ਦਾਂਗੇ ਉਹ

ਠੀਕ ਐ ਹਾਂ ਤੁਹਾਨੂੰ ਫੋਨ ਕਰਕੇ ਦੱਸ ਦਾਂਗੇ ਤੇ ਫਿਰ ਆਪਾਂ ਇੱਕ ਦਿਨ ਚੱਲਾਂਗੇ ਆਪਾਂ ਆਪਣੇ ਬੱਚੇ ਉਥੇ ਹੀ ਪਾ ਦਾਂਗੇ ਗੁਰੂ ਨਾਨਕ ਸਕੂਲ ਠੀਕ ਐ ਹਾਂ ਸਹੀ ਗੱਲ ਜਾਣ ਪਹਿਚਾਣ ਤਾਂ ਆਪਣੇ ਬੱਚੇ ਵਧੀਆ ਰਹਿਣਗੇ ਉਥੇ ਚਲੋ ਠੀਕ ਐ ਫਿਰ ਕੋਲ ਵੀ ਨੀ ਕਰਦਾ ਠੀਕ ਐ ਓਕੇ